ਸਾਡੇ ਸੱਭਿਆਚਾਰ ਦੇ ਵਿਚ ਔਰਤਾਂ ਵਿਚ ਮਹਾਂਵਾਰੀ ਦਾ ਇਲਾਜ ਇਸ ਤਰ੍ਹਾਂ ਕੀਤਾ ਜਾਂਦਾ ਜਿੱਦਾਂ ਕਿ ਹੈ ਨਾ ਮਹਾਂਵਾਰੀ ਦੇ ਦੌਰਾਨ ਹੈ ਨਾ ਕੁੜੀਆਂ ਨੂੰ ਬ ਪਾਣੀ ਦੀ ਬੋਟਲ ਹੈ ਨਾ ਗਰਮ ਮਤਲਬ ਕੱਚ ਦੀ ਬੋਤਲ ਦੇ ਵਿੱਚ ਹੈ ਨਾ ਗਰਮ ਪਾਣੀ ਪਾ ਕੇ ਉਹਨੂੰ ਕੋਸੀ ਕਰਕੇ ਉਹਨੂੰ ਫੇਰਿਆ ਜਾਂਦਾ ਹੈ ਨਾ ਉਹਦੇ ਨਾਲ ਦਰਦ ਠੀਕ ਹੋ ਜਾਂਦਾ ਜਿੱਦਾਂ ਕਿ ਹੈ ਨਾ ਕੇਲਾ ਖਾ ਲਿਆ ਜਾਂਦਾ ਜਿਸਦੇ ਨਾਲ ਦਰਦ ਤੋਂ ਸਾਨੂੰ ਰਾਹਤ ਮਿਲਦੀ ਹੈ ਜਿੱਦਾਂ ਕਿ ਹੋਰ ਨੁਸਖਿਆਂ ਦੇ ਵਿੱਚ ਹੋ ਗਿਆ ਹੈ ਨਾ ਜਿੱਦਾਂ ਕਿ ਜਿਹੜੀ ਚੋਕਲੇਟ ਹੁੰਦੀ ਆ ਚੋਕਲੇਟ ਨੂੰ ਖਾ ਕੇ ਵੀ ਸਾਡਾ ਦਰਦ ਘੱਟ ਜਾਂਦਾ ਹੈ ਹੈ ਨਾ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਹੈ ਨਾ ਜਿਹੜੀਆਂ ਔਰਤਾਂ ਸੀਗੀਆਂ ਹੈ ਨਾ ਉਨ੍ਹਾਂ ਦੇ ਉੱਤੇ ਕੁਝ ਨਿਯਮ ਲਾਗੂ ਹੁੰਦੇ ਸੀਗੇ ਪਹਿਲਾਂ ਦੇ ਟਾਇਮ ਵਿੱਚ ਲੋਕ ਇੱਦਾਂ ਕਰਦੇ ਸੀਗੇ ਵੀ ਜਿਹੜੀਆਂ ਔਰਤਾਂ ਨੂੰ ਹੈ ਨਾ ਜਦੋਂ ਮਹਾਂਵਾਰੀ ਆਈ ਹੈ ਤਾਂ ਉਹ ਰਸੋਈ ਦੇ ਵਿੱਚ ਜਾ ਕੇ ਕੰਮ ਨਹੀਂ ਕਰ ਸਕਦੀਆਂ ਅਤੇ ਉਹਨਾਂ ਨੂੰ ਅਸ਼ੁੱਧ ਮੰਨਿਆ ਜਾਂਦਾ ਸੀਗਾ ਪਰ ਹੈ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਦੱਸਿਆ ਗਿਆ ਵੀ ਜਦੋਂ ਵੀ ਕਿਸੇ ਔਰਤ ਨੂੰ ਮਹਾਵਾਰੀ ਹੁੰਦੀ ਹੈ ਹੈ ਨਾ ਇੱਦਾਂ ਦਾ ਕੁਛ ਵੀ ਹੁੰਦਾ ਤਾਂ ਉਹ ਔਰਤ ਜੂਠੀ ਨਹੀਂ ਹੁੰਦੀ ਅਤੇ ਉਹ ਰਸੋਈ ਦੇ ਵਿੱਚ ਜਾ ਸਕਦੀ ਹੈ ਹੈ ਨਾ ਅਤੇ ਆਪਣਾ ਕੰਮ ਕਰ ਸਕਦੀ ਹੈ ਹਾਂ ਅੱਜ ਦੇ ਟਾਈਮ ਵਿੱਚ ਸਵੱਛਤਾ ਅਤੇ ਸਿਹਤ ਬਾਰੇ ਹੈ ਨਾ ਕਾਫੀ ਜ਼ਿਆਦਾ ਜਾਗਰੂਕਤਾ ਜਿੱਦਾਂ ਪਹਿਲਾਂ ਦੇ ਸਮਿਆਂ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਉਹ ਕੱਪੜਾ ਵਰਤਦੀਆਂ ਸੀਗੀਆਂ ਅਤੇ ਅੱਜ ਕੱਲ੍ਹ ਲੋਕ ਜਾਗਰੂਕ ਹੋ ਗਏ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਦਾਂ ਕਰਨ ਨਾਲ ਕੀਟਾਣੂ ਪੈਦਾ ਹੁੰਦੇ ਹੈ ਅਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਗਈਆਂ ਅਤੇ ਅੱਜ ਕੱਲ੍ਹ ਲੋਕ ਜਾਗਰੂਕ ਹੋ ਗਏ ਅਤੇ ਅੱਜ ਕੱਲ੍ਹ ਉਹ ਪੈਡ ਵਰਤਦੇ ਆ ਜਿਸ ਕਰਕੇ ਉਨ੍ਹਾਂ ਨੂੰ ਵਧੀਆ ਫੀਲ ਹੁੰਦਾ ਹੈ ਅਤੇ ਵਧੀਆ ਤਰੀਕੇ ਨਾਲ ਹੈ ਨਾ ਮਹਾਵਾਰੀ ਦੇ ਦਿਨ ਲੰਘ ਜਾਂਦੇ ਹੈ